ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਜਿਹੜਾ ਹੈ ਉਹ ਤਿਉਹਾਰਾਂ ਦਾ ਪੰਜਾਬ ਹੈ ਤਿਉਹਾਰਾਂ ਦੀ ਧਰਤੀ ਹੈ ਔਰ ਇੱਥੇ ਕਈ ਪ੍ਰਕਾਰ ਦੇ ਜਾਂ ਕਈ ਤਰ੍ਹਾਂ ਦੇ ਤਿਉਹਾਰ ਜਿਹੜੇ ਆ ਉਹ ਮਨਾਏ ਜਾਂਦੇ ਨੇ ਜਿਵੇਂ ਲੋਹੜੀ ਮਾਘੀ ਬਸੰਤ ਵਗੈਰਾ ਸੋ ਰਹੀ ਗੱਲ ਪਕਵਾਨ ਦੀ ਤਾਂ ਤਿਉਹਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਬੜੇ ਖਾਸ ਖਾਸ ਜਿਹੜੇ ਪਕਵਾਨ ਉਹ ਬਣਾਏ ਜਾਂਦੇ ਨੇ ਜਿਵੇਂ ਲੋਹੜੀ ਦੇ ਉੱਤੇ ਸਾਗ ਦਾ ਬਣਨਾ ਬਹੁਤ ਜ਼ਰੂਰੀ ਹੈ ਇਹ ਸ਼ੁੱਭ ਮੰਨਿਆ ਗਿਆ ਸਾਗ ਦਾ ਬਣਨਾ ਇਸ ਤੋਂ ਇਲਾਵਾ ਖਿਚੜੀ ਦਾ ਬਣਨਾ ਜਾਂ ਗੰਨੇ ਦੀ ਰਸ ਦਾ ਰਸ ਦੀ ਜਿਹੜੀ ਖੀਰ ਹੈ ਉਹ ਜਿਹੜੀ ਹੈ ਉਹ ਬੜੇ ਸ਼ੌਂਕ ਨਾਲ ਖਾਂਦੀ ਜਾਂਦੀ ਹੈ ਦੀਵਾਲੀ 'ਤੇ ਵੀ ਘਰ ਦੇ ਵਿੱਚ ਲੋਕ ਬਣਾਉਂਦੇ ਨੇ ਪਕੌੜੇ ਬਣਾਉਂਦੇ ਨੇ ਜਾਂ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਜਿਹੜੀਆਂ ਮਿਠਿਆਈਆਂ ਵਗੈਰਾ ਇਹ ਬਣਦੀਆਂ ਨੇ ਮਿੱਠੀ ਚੀਜ਼ ਖਾਣ ਨੂੰ ਬਣਦੀ ਹੈ ਦੁਸਹਿਰੇ 'ਤੇ ਵੀ ਜਿਵੇਂ ਦੇਖ ਲਓ ਕਿ ਗੰਨੇ ਦਾ ਰਸ ਜਿਹੜਾ ਆ ਉਹ ਮਿਲਦਾ ਖਾਣ ਨੂੰ ਜਲੇਬੀ ਵਗੈਰਾ ਜਾਂ ਘਰ ਦੇ ਵਿੱਚ ਅਸੀਂ ਗੰਨੇ ਦਾ ਰਸ ਵੀ ਜਿਹੜਾ ਕੱਢਦੇ ਹਾਂ ਪਿੰਡਾਂ ਦੇ ਵਿੱਚ ਇਹ ਖਾਸ ਇਹਦੇ ਤਿਉਹਾਰ ਦੀ ਪਹਿਛਾਣ ਹੈ ਇਸ ਤੋਂ ਇਲਾਵਾ ਬਸੰਤ ਦਾ ਤਿਉਹਾਰ ਜਿਵੇਂ ਦੇਖ ਲਈਏ ਤਾਂ ਬਸੰਤ ਦੇ ਵਿੱਚ ਜਿਵੇਂ ਉਹਦਾ ਰੰਗ ਹੈ ਕੇਸਰੀ ਪੀਲਾ ਇਹੋ ਜਿਹੀ ਆਪਾਂ ਕੋਈ ਚੀਜ਼ ਜਿਵੇਂ ਚੌਲ ਵਗੈਰਾ ਮਿੱਠੇ ਜਿਹੜੇ ਆ ਉਹ ਪੀਲੇ ਰੰਗ ਦੇ ਬਣਾਏ ਜਾਂਦੇ ਨੇ ਅਤੇ ਬੜੇ ਸ਼ੌਂਕ ਨਾਲ ਖਾਦੇ ਜਾਂਦੇ ਨੇ ਧੰਨਵਾਦ